ਸਾਡੇ ਰਾਜਸੀ ਸੱਭਿਆਚਾਰਕ ਪਛਾਣ ਵਿੱਚ ਪੰਜਾਬੀ ਭਾਸ਼ਾ ਬਹੁਤ ਹੀ ਵੱਡੀ ਭੂਮਿਕਾ ਨਿਭਾਉਦੀ ਹੈ ਜਿਸ ਤਰ੍ਹਾਂ ਲੋਕ ਗੀਤ ਲੋਕ ਨਾਚ ਭੰਗੜਾ ਹਰ ਚੀਜ਼ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਗੁਰਮਤਿ ਵਿਚਾਰਾਂ ਹਰ ਚੀਜ਼ ਆਪਣੇ ਪੰਜਾਬੀ ਭਾਸ਼ਾ ਵਿੱਚ ਇਸਦਾ ਬਹੁਤ ਹੀ ਵੱਡਾ ਯੋਗਦਾਨ ਹੈ ਪੰਜਾਬੀ ਭਾਸ਼ਾ ਸਾਡੇ ਲਈ ਸਾਡੀ ਇੱਕ ਮਾਤ ਭਾਸ਼ਾ ਹੈ ਜੋ ਕਿ ਭਾਵੇਂ ਸਾਡੇ ਵਿਚਕਾਰ ਬਹੁਤ ਸਾਰੀਆਂ ਭਾਸ਼ਾਵਾਂ ਹਨ ਅੰਗਰੇਜ਼ੀ ਉਰਦੂ ਹੋਰ ਕਈ ਦੇਸ਼ਾਂ ਦੀਆਂ ਕਈ ਭਾਸ਼ਾਵਾਂ ਹਨ ਬਟ ਪਰ ਆ ਪਰ ਪੰਜਾਬੀ ਭਾਸ਼ਾ ਸੱਭਿਆਚਾਰਕ ਵਿੱਚ ਸਾਡੀ ਇੱਕ ਬਹੁਤ ਹੀ ਵੱਡੀ ਭੂਮਿਕਾ ਨਿਭਾਉਂਦੀ ਹੈ ਪੰਜਾਬੀ ਭਾਸ਼ਾ ਨਾਲ ਅਸੀ ਲੋਕਾਂ ਨੂੰ ਬੜੇ ਸੌਖੇ ਤਰੀਕੇ ਨਾਲ ਸਮਝਾ ਸਕਦੇ ਹਾਂ ਔਰ ਇਸ ਦੀ ਇ ਕਈ ਲੇਖਕ ਕਈ ਕਵਿਤਾਵਾਂ ਲੇਖਕਾਂ ਬੁਮ ਪੰਜਾਬੀ ਕਹਾਣੀਆਂ ਪੰਜਾਬੀ ਭਾਸ਼ਾ ਵਿੱਚ ਬਹੁਤ ਹੀ ਨਾਟਕਕਾਰ ਗੀਤਕਾਰ ਉਹਨਾਂ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਇਸ ਨੂੰ ਨਿਭਾਇਆ ਹੈ ਪੰਜਾਬੀ ਭਾਸ਼ਾ ਵਿੱਚ ਉਹਨਾਂ ਨੂੰ ਲੇਖ ਲਿਖ ਕੇ ਸਾਰਿਆਂ ਨੂੰ ਬੜੇ ਚੰਗੇ ਸੌਖੇ ਤਰੀਕੇ ਨਾਲ ਸਮਝਾਇਆ ਹੈ